ਨਵਜੰਮੇ ਬੱਚਿਆਂ ਨੂੰ ਜੇਕਰ ਸਵੱਛ ਵਾਤਾਵਰਨ ਦੇਣ ਦੀ ਗੱਲ ਤੁਰੇ ਤਾਂ ਸਭ ਤੋਂ ਪਹਿਲਾਂ ਇਹ ਗੱਲ ਸਾਡੇ ਘਰ 'ਤੇ ਲਾਗੂ ਹੁੰਦੀ ਹੈ ਸਾਨੂੰ ਦੇਖਣਾ ਚਾਹੀਦਾ ਹੈ ਕਿ ਘਰ ਦੀ ਬਗੀਚੀ ਵਿੱਚ ਜੋ ਵੀ ਫਸਲਾਂ ਨੇ ਜਾਂ ਫਲ ਉਗਾਏ ਜਾਂਦੇ ਹਨ ਉਹਨਾਂ ਉੱਤੇ ਸਪਰੇਆਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਕਿਉਂਕਿ ਜਿਹੜਾ ਖਾਣਾ ਬੱਚੇ ਦੀ ਮਾਂ ਲਏਗੀ ਉਹ ਹੀ ਦੁੱਧ ਦੇ ਜ਼ਰੀਏ ਬੱਚੇ ਦੇ ਅੰਦਰ ਜਾਣਾ ਹੈ ਇਸ ਲਈ ਸਾਨੂੰ ਸਪਰੇਆਂ ਦੀ ਵਰਤੋਂ ਨਾ ਦੇ ਬਰਾਬਰ ਹੀ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਕੁਦਰਤੀ ਖੇਤੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਬੱਚੇ ਦਾ ਸਰੀਰ ਤੰਦਰੁਸਤ ਹੋਵੇਗਾ ਤਾਂ ਜਾ ਕੇ ਅੱਗੇ ਉਹਦਾ ਵਿਕਾਸ ਹੋ ਸਕਦਾ ਹੈ ਦੂਜੀ ਗੱਲ ਪਰਿਵਾਰ ਵਿੱਚ ਜਿਹੜੇ ਵੀ ਮੈਂਬਰ ਹਨ ਜੇਕਰ ਉਹ ਬੱਚੇ ਦੇ ਨਜ਼ਦੀਕ ਆਉਣਾ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਉਹ ਕਿਸੇ ਬਿਮਾਰੀ ਤੋਂ ਗ੍ਰਸਤ ਨਾ ਹੋਣ ਅਗਰ ਕੋਈ ਬਿਮਾਰੀ ਦੇਖੀ ਵੀ ਜਾਂਦੀ ਹੈ ਤਾਂ ਉਹਨਾਂ ਨੂੰ ਆਪਣਾ ਉਪਚਾਰ ਕਰਾ ਲੈਣਾ ਚਾਹੀਦਾ ਹੈ ਜਾਂ ਫਿਰ ਕੋਈ ਬਚਾਅ ਦਾ ਸਾਧਨ ਲੈ ਕੇ ਬੱਚੇ ਤੱਕ ਪਹੁੰਚ ਕਰਨੀ ਚਾਹੀਦੀ ਹੈ